ਸਾਡੇ ਖੇਤਰ ਮਤਲਬ ਕਿ ਜਿਵੇਂ ਕਿ ਸਕੂਲ ਪੱਧਰ 'ਤੇ ਜਿਹੜੇ ਖਿਡਾਰੀਆਂ ਦੀ ਵੀ ਕਿਵੇਂ ਪਹਿਚਾਣ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਖਿਡਾਰੀ ਸਕੂਲ ਪੱਧਰ 'ਤੇ ਖਿਡਾਰੀ ਹੁੰਦੇ ਆ ਉਹਨਾਂ ਦੀ ਪਹਿਚਾਣ ਕਰਨ ਲਈ ਸਕੂਲ ਵਿੱਚ ਗੇਮਾਂ ਕਰਵਾਈਆਂ ਜਾਂਦੀਆਂ ਇਹਨਾਂ ਵਿੱਚ ਦੇਖਿਆ ਜਾਂਦਾ ਵੀ ਕਿਹੜਾ ਖਿਡਾਰੀ ਕਿਸ ਗੇਮ ਵਿੱਚ ਸਮਰੱਥ ਹੈ ਇਸ ਤੋਂ ਬਾਅਦ ਇਹਨਾਂ ਖਿਡਾਰੀਆਂ ਨੂੰ ਖੇਡਾਂ ਖਿਡਾਉਣ ਲਈ ਪਹਿਲਾਂ ਸੈਂਟਰ ਲੈਵਲ 'ਤੇ ਗੇਮਾਂ ਹੁੰਦੀਆਂ ਨੇ ਸੈਂਟਰ ਲੈਵਲ ਵਿੱਚ ਜੋ ਬੱਚੇ ਵਧੀਆ ਪ੍ਰਦਰਸ਼ਨ ਕਰਦੇ ਉਹਨਾਂ ਨੂੰ ਅੱਗੇ ਬਲੋਕ ਲੈਵਲ 'ਤੇ ਲਿਜਾਇਆ ਜਾਂਦਾ ਬਲੋਕ ਲੈਵਲ ਵਿੱਚ ਜੋ ਬੱਚੇ ਵਧੀਆ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਅੱਗੇ ਡਿਸਟ੍ਰਿਕਟ ਲੈਵਲ 'ਤੇ ਖਿਡਾਇਆ ਜਾਂਦਾ ਡਿਸਟਰਿਕਟ ਲੈਵਲ ਤੋਂ ਬਾਅਦ ਉਹਨਾਂ ਵਿਦਿਆਰਥੀਆਂ ਨੂੰ ਸਟੇਟ ਲੈਵਲ ਲਈ ਖਿਡਾਇਆ ਜਾਂਦਾ ਸਟੇਟ ਲੈਵਲ 'ਤੇ ਖਿਡਾਉਣ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਜੇ ਸਟੇਟ ਜੇ ਜੇਤੂ ਖਿਡਾਰੀ ਹੁੰਦੇ ਨੇ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਇਨਾਮ ਦਿੱਤੇ ਜਾਂਦੇ ਨੇ ਇਨਾਮ ਦੇ ਨਾਲ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਜਿੱਤੀਆਂ ਜਾਂਦੀਆਂ ਨੇ ਜਿਵੇਂ ਕਿ ਉਹਨਾਂ ਨੂੰ ਸਪੋਰਟਸ ਕਿੱਟ ਵ ਹੋ ਗਈਆਂ ਇਹ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਇਹਨਾਂ ਸਹੂਲਤਾਂ ਪ੍ਰਦਾਨ ਕਰਨ ਤੋਂ ਬਾਅਦ ਜਦੋਂ ਉਹ ਖਿਡਾਰੀ ਆਪਣਾ ਦੇਸ਼ ਔਰ ਨੈਸ਼ਨਲ ਲੈਵਲ 'ਤੇ ਆਪਣੀ ਸਟੇਟ ਨੂੰ ਪ੍ਰਦ ਸਟੇਟ ਨੂੰ ਰੀਪ੍ਰਜੈਂਟ ਕਰਨ ਜਾਂ ਤਾਂ ਉਦੋਂ ਵੀ ਬਹੁਤ ਸਾਰੀਆਂ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਜਿਵੇਂ ਕਿ ਉਹਨਾਂ ਦਾ ਆਉਣ ਜਾਣ ਦਾ ਖਰਚਾ ਲਗਾ ਲਓ ਇਹ ਸਾਰਾ ਕੁਛ ਉਹਨਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਜੋ ਸਟ ਨੈਸ਼ਨਲ ਲੈਵਲ 'ਤੇ ਖਿਡਾਰੀ ਜਾਂਦੇ ਨੇ ਉਹਨਾਂ ਨੂੰ ਇੱਕ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਸਨਮਾਨਿਤ ਦੇ ਨਾਲ ਨਾਲ ਉਹਨਾਂ ਨੂੰ ਕੋ ਰਾਸ਼ੀ ਦੇ ਕੇ ਰਾਸ਼ੀ ਲਾ ਲਓ ਜਾਂ ਕੋਈ ਵੀ ਹੋਰ ਕੋਈ ਉਪਹਾਰ ਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਇਸ ਤੋਂ ਇਲਾਵਾ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਇਹਨਾਂ ਖਿਡਾਰੀਆਂ ਦੇ ਉਪਰਾਲੇ ਵੀ ਕੀਤੇ ਜਾਂਦੇ ਅਤੇ ਇਹਨਾਂ ਨੂੰ ਕੋਚਿੰਗਾਂ ਦਿੱਤੀਆਂ ਜਾਂਦੀਆਂ ਨੇ ਇਹਨਾਂ ਖਿਡਾਰੀਆਂ ਲਈ ਵੱਖਰੇ ਤੌਰ 'ਤੇ ਖੇਡ ਮੈਦਾਨ ਤਿਆਰ ਕੀਤੇ ਨੇ ਜਿੱਥੇ ਕਿ ਇਹਨਾਂ ਨੂੰ ਸਪੈਸ਼ਲ ਟ੍ਰੇਨਰ ਨਿਯੁਕਤ ਕਰਕੇ ਇਹਨਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾਣ ਤਾਂ ਕਿ ਤਾਂ ਕਿ ਇਹ ਖਿਡਾਰੀ ਅੱਗੇ ਜਾ ਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਅਤੇ ਨਾਲ ਦੀ ਨਾਲ ਇਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ